ਜਿੱਥੋਂ ਤੱਕ ਮੇਰਾ ਪਹਿਲੀ ਵਾਰੀ ਗੱਤਕਾ ਸਿੱਖਣ ਦਾ ਸਵਾਲ ਹੈ ਮੈਨੂੰ ਯਾਦ ਹੈ ਕਿ ਸਾਡੇ ਪਿੰਡ ਦੇ ਸਕੂਲ ਦੇ ਨੇੜੇ ਇੱਕ ਸਕੂਲ ਹੁੰਦਾ ਸੀ ਜਿਹਨੂੰ ਆਪਾਂ ਪੀਰ ਬਾਬਾ ਜਿੰਦਾ ਸ਼ਹੀਦ ਸਕੂਲ ਦੇ ਨਾਂ ਨਾਲ ਜਾਣਦੇ ਸੀ ਉੱਥੇ ਸਾਡੀਆਂ ਕੁਝ ਸਿੱਖ ਨੌਜਵਾਨ ਸੁਸਾਇਟੀਆਂ ਦੇ ਵੱਲੋਂ ਗੱਤਕਾ ਸਿਖਾਉਣ ਦੀ ਜਿਹੜੀ ਰਸਮ ਅਰੰਭੀ ਗਈ ਉਸ ਵਕਤ ਸਾਡੇ ਪਿੰਡ ਵਿੱਚ ਇੱਕ ਗੱਡੀ ਆਉਂਦੀ ਵੈਨ ਉਹ ਸਾਨੂੰ ਸ਼ਾਮ ਨੂੰ ਚਾਰ ਵਜੇ ਲੈ ਕੇ ਜਾਂਦੀ ਅਤੇ ਸਾਡੀ ਦੋ ਘੰਟੇ ਦੀ ਸਿਖਲਾਈ ਜਿਹੜੀ ਗੱਤਕਾ ਸਿੱਖਣ ਦੀ ਅਤੇ ਸ਼ੁਰੂ ਹੁੰਦੀ ਮੇਰੇ ਪਿੰਡ ਤੋਂ ਬਹੁਤ ਸਾਰੇ ਸਾਡੇ ਮੇਰੇ ਨਾਲ ਦੇ ਨੌਜਵਾਨ ਸਾਥੀ ਉਸ ਟਾਈਮ ਬੱਚੇ ਹੁੰਦੇ ਸੀ ਆਪਾਂ ਉਹਨਾਂ ਨੂੰ ਜਾਂਦੇ ਦੇਖਦੇ ਤਾਂ ਮੇਰੀ ਵੀ ਗੱਤਕਾ ਸਿੱਖਣ ਦੀ ਜਿਹੜੀ ਰੁਚੀ ਹੈ ਉਹ ਪੈਦਾ ਹੋ ਗਈ ਹਲੇ ਕਿ ਮੈਂ ਸਿਰ ਪਰ ਬਾਲ ਨਹੀਂ ਸਨ ਰੱਖੇ ਲੇਕਿਨ ਮੈਂ ਪੂਰਨ ਤੌਰ ਦੇ ਉੱਤੇ ਸਰਦਾਰ ਨਹੀਂ ਸੀ ਮੇਰੇ ਸਿਰ 'ਤੇ ਜੂੜਾ ਨਹੀਂ ਸੀ ਪਰ ਫਿਰ ਪਰ ਫਿਰ ਵੀ ਮੈਂ ਆਪਣੇ ਨੌਜਵਾਨ ਸਾਥੀਆਂ ਦੇ ਨਾਲ ਤੇ ਉਸ ਟਾਈਮ ਬੱਚੇ ਸਨ ਉਹਨਾਂ ਦੇ ਨਾਲ ਗਤਕਾ ਸਿੱਖਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਗਤਕਾ ਸਿੱਖਣ ਦੀ ਰੁਚੀ ਹੈ ਜਿਹੜੀ ਉਹ ਦਿਨ ਪਰ ਦਿਨ ਵੱਧਦੀ ਰਹੀ ਉਸ ਵਕਤ ਸਾਨੂੰ ਗਤਕਾ ਸਿੱਖਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਲਵਾਰ ਜਾਂ ਕਿਰਪਾਨ ਨਹੀਂ ਸੀ ਫੜਾਈ ਜਾਂਦੀ ਸਗੋਂ ਉਸ ਵਕਤ ਸਾਨੂੰ ਡੰਟੇ ਲਾਠੀਆਂ ਸਾਡੇ ਹੱਥਾਂ ਦੇ ਵਿੱਚ ਦੇ ਦਿੱਤੀਆਂ ਜਾਂਦੀਆਂ ਸਨ ਜਿਹਨਾਂ ਨੂੰ ਸਾਨੂੰ ਹੌਲੀ ਹੌਲੀ ਚਲਾਉਣਾ ਸਾਡੇ ਜਿਹੜੇ ਸਿਖਲਾਈ ਦੇ ਸਾਡੇ ਜਿਹੜੇ ਟੀਚਰ ਸਨ ਜਿਹੜੇ ਟ੍ਰੇਨਿੰਗ ਸਾਨੂੰ ਦਿੰਦੇ ਸਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਨੌਜਵਾਨ ਸਨ ਉਹਨਾਂ ਦੁਆਰਾ ਸਾਨੂੰ ਚਲਾਇਆ ਜਾਂਦਾ ਸੀ ਸੋ ਇਸ ਤਰ੍ਹਾਂ ਸਾਡੀ ਗੱਤਕੇ ਦੇ ਵਿੱਚ ਰੁਚੀ ਦਿਨ ਪਰ ਦਿਨ ਵੱਧਦੀ ਗਈ ਇਸ ਦੇ ਉਲਟ ਗੱਤਕਾ ਸਿੱਖਣ ਦੀ ਰੁਚੀ ਉਸ ਵਕਤ ਵੀ ਸਾਡੀ ਵਧੀ ਜਦੋਂ ਅਸੀਂ ਕਿਸੇ ਸਮਾਗਮ 'ਤੇ ਜਾਂਦੇ ਗੁਰਦੁਆਰਾ ਸਾਹਿਬ ਦੇ ਵਿੱਚ ਉਦੋਂ ਕੀਰਤਨ ਹੁੰਦੇ ਪਿੰਡਾਂ ਦੇ ਵਿੱਚ ਤਾਂ ਕੀਰਤਨ ਦੇ ਦੌਰਾਨ ਜਿਹੜੇ ਨੌਜਵਾਨ ਸਾਥੀ ਆ ਜਿਹੜੇ ਸਿੰਘ ਨਿਹੰਗ ਸਿੰਘ ਫੌਜਾਂ ਏ ਉਹਨਾਂ ਦੇ ਦੀਵਾਨ ਗਤਕੇ ਦੇ ਜਿਹੜੇ ਕਰਤਬ ਆ ਉਹ ਦਿਖਾਏ ਜਾਂਦੇ ਉਹਨਾਂ ਨੂੰ ਦੇਖਣ ਤੋਂ ਬਾਅਦ ਮਨ ਦੇ ਵਿੱਚ ਇੱਕ ਵਿਲੱਖਣ ਉਤਸ਼ਾਹ ਸਾਡੇ ਪੈਦਾ ਹੁੰਦਾ ਜਿਸ ਨੂੰ ਦੇਖ ਕੇ ਇੰਝ ਲੱਗਦਾ ਕਿ ਸਾਨੂੰ ਵੀ ਇਹ ਸਿੱਖਣਾ ਬਹੁਤ ਜ਼ਰੂਰੀ ਹੈ ਆਪਣੀ ਜਿਹੜੀ ਸੈਲਫ ਪ੍ਰੋਟੈਕਸ਼ਨ ਦੇ ਵਾਸਤੇ ਸੈਲਫ ਡਿਫੈਂਸ ਦੇ ਵਾਸਤੇ ਗਤਕਾ ਸਿੱਖਣ ਦੀ ਉਸ ਵਕਤ ਸਾਡੇ ਵਿੱਚ ਰੂਚੀ ਪੈਦਾ ਹੋਈ